ਨਮਸਤੇ ਮੇਰਾ ਨਾਮ ਸਿਮਰਨ ਹੈ ਮੈਂ ਦਸ ਦਿਨ ਪਹਿਲੇ ਐਮਜ਼ੋਨ ਤੋਂ ਇੱਕ ਟਰੋਲੀ ਬੈਗ ਔਡਰ ਕੀਤਾ ਸੀ ਅਤੇ ਜਿਹਦੀ ਡਿਲੀਵਰੀ ਦੋ ਦਿਨ ਪਹਿਲੇ ਐਕਸਪੈਕਟਿਡ ਸੀਗੀ ਲੇਕਿਨ ਐਮਾਜ਼ੋਨ ਵਾਲਿਆਂ ਨੇ ਕੱਲ੍ਹ ਡਿਲੀਵਰ ਕੀਤੀ ਅਤੇ ਲਾਈਕ ਦਸ ਦਿਨ ਪਹਿਲੇ ਔਡਰ ਕੀਤਾ ਹੈ ਦੋ ਦਿਨ ਦੀ ਡਿਲੀਵਰੀ ਦੱਸ ਰਹੇ ਸੀ ਟਾਈਮਿੰਗ 'ਤੇ ਤੁਸੀਂ ਮੈਨੂੰ ਉਸ ਦਿਨ ਡਿਲੀਵਰ ਕਰ ਰਹੇ ਹੋ ਯਾਨੀ ਕਿ ਕੱਲ੍ਹ ਅਤੇ ਚਲੋ ਉਹ ਵੀ ਠੀਕ ਹੈ ਮੈਂ ਜਿਸ ਕੰਪਨੀ ਦਾ ਔਡਰ ਕੀਤਾ ਪਹਿਲਾਂ ਤਾਂ ਮੈਨੂੰ ਉਹ ਕੰਪਨੀ ਤੋਂ ਆਇਆ ਨਹੀਂ ਠੀਕ ਹੈ ਫਿਰ ਜਿਹੜਾ ਕਲਰ ਸੀਗਾ ਉਹ ਕਲਰ ਵੀ ਨਹੀਂ ਆਇਆ ਤਾਂ ਮਤਲਬ ਜਿਹੜੀ ਟਰੋਲੀ ਬੈਗ ਮੈਨੂੰ ਮਿਲਿਆ ਉਹ ਮਤਲਬ ਮੈਂ ਦੱਸਾਂ ਉਹ ਯੂਜ਼ ਕਰਨ ਦੀ ਹਾਲਤ 'ਚ ਵੀ ਨਹੀਂ ਸੀ ਮੈਂ ਉਹ ਟਰੋਲੀ ਬੈਗ ਮੈਨੂੰ ਬਹੁਤ ਜ਼ਰੂਰੀ ਚਾਹੀਦਾ ਸੀ ਮੈਂ ਪਹਿਲੇ ਸਭ ਕੁਛ ਚੈੱਕ ਕਰਕੇ ਔਨਲਾਈਨ ਕਿ ਅੱਛਾ ਇਹ ਵਾਲੇ ਦਿਨ ਜਿਸ ਦਿਨ ਮੈਨੂੰ ਚਾਹੀਦਾ ਉਸ ਤੋਂ ਦੋ ਦਿਨ ਪਹਿਲੇ ਮੈਂ ਐਕਸਪੈਕਟ ਕਰ ਰਹੀ ਸੀ ਕਿ ਆ ਜਾਏਗਾ ਅਤੇ ਮੈਂ ਕਿਤੇ ਲੈ ਕੇ ਜਾਣਾ ਸੀ ਬਟ ਮੈਨੂੰ ਮਿਲਿਆ ਹੀ ਨਹੀਂ ਮਤਲਬ ਇੱਕ ਤਾਂ ਤੁਸੀਂ ਡਿਲੀ ਇੰਨਾ ਲੇਟ ਕਰ ਰਹੇ ਹੋ ਠੀਕ ਹੈ ਅਤੇ ਦੂਸਰਾ ਜਿਹੜਾ ਡਿਲੀਵਰੀ ਪਾਰਟਨਰ ਸੀ ਉਹਨੇ ਇੰਨੀ ਬਤਮੀਜ਼ੀ ਨਾਲ ਗੱਲ ਕੀਤੀ ਮਤਲਬ ਜੇ ਆਪਾਂ ਉਹਨੂੰ ਪੁੱਛ ਲਿਆ ਫਿਰ ਪਤਾ ਨਹੀਂ ਕਿਉਂ ਜਿਹੜਾ ਓ ਟੀ ਪੀ ਦੀ ਰਿਕੁਆਇਰਮੈਂਟ ਵੀ ਨਹੀਂ ਹੁੰਦੀ ਉਹ ਵੀ ਮੰਗ ਰਿਹਾ ਸੀ ਸੋ ਮੇਰਾ ਤਾਂ ਐਕਸਪੀਰੀਅਸ ਬਹੁਤ ਹੀ ਵਰਸਟ ਸੀ ਇਸ ਮਾਮਲੇ 'ਚ ਅਤੇ ਮੈਂ ਔਨਲਾਈਨ ਰੇਟਿੰਗ ਵੀ ਦਿੱਤੀ ਉਹਨਾਂ ਨੂੰ ਜਿੱਥੇ ਜਾ ਕੇ ਦੇ ਸਕਦੇ ਹਾਂ ਅਤੇ ਮੈਂ ਬਹੁਤ ਨੈਗੇਟਿਵ ਰੇਟਿੰਗ ਦਿੱਤੀ ਜਾ ਕੇ ਵਨ ਵਨ ਪੁਆਇੰਟ ਹਾਫ ਸਮਥਿੰਗ ਅਤੇ ਕਲਰ ਵੀ ਉਸ ਨਹੀਂ ਸੀ ਔਰ ਟਰੋਲੀ ਬੈਗ ਵਿੱਚ ਵੀ ਨਹੀਂ ਸੀ ਆਇਆ ਅਤੇ ਮੈਂ ਆਈ ਡੋਂਟ ਥਿੰਕ ਕਿ ਮੈਂ ਦੁਬਾਰਾ ਇੱਥੋਂ ਔਡਰ ਕਰਾਂਗੀ ਕੁਛ ਮੈਨੂੰ ਬਿਲਕੁਲ ਨਹੀਂ ਪਸੰਦ ਆਇਆ ਬਿਲਕੁਲ ਨਹੀਂ ਪਸੰਦ ਮੇਰਾ ਤਾਂ ਐਕਸਪੀਰੀਅਸ ਬਹੁਤ ਹੀ ਮਾੜਾ ਰਿਹਾ ਬਹੁਤ ਮਾੜਾ ਰਿਹਾ ਐਮਾਜ਼ੋਨ ਵਾਲਿਆ ਵਾਲਾ ਜਿਹੜੀ ਮੈਂ ਕੰਪਨੀ ਦਾ ਮੰਗਵਾਇਆ ਪਹਿਲਾਂ ਤਾਂ ਉਹ ਨਹੀਂ ਆਇਆ ਫਿਰ ਉਹਨੂੰ ਉਹਦਾ ਬਰਥ ਨਹੀਂ ਲੱਗਿਆ ਜਿਹੜਾ ਮੰਗਵਾਇਆ ਸੀ ਦੇਖੋ ਜੀ ਇੱਕ ਤਾਂ ਚੀਜ਼ ਟਾਈਮ 'ਤੇ ਨਹੀਂ ਆਈ ਦੂਸਰਾ ਕਲਰ ਨਹੀਂ ਸੇਮ ਆਇਆ ਕੁਆਲਿਟੀ ਦਾ ਵੀ ਫ਼ਰਕ ਸੀ ਅਤੇ ਮੈਨੂੰ ਤਾਂ ਬਿਲਕੁਲ ਨਹੀਂ ਅੱਛਾ ਲੱਗਿਆ ਬਿਲਕੁਲ ਨਹੀਂ ਅੱਛਾ